ਹੈਲੋ ਸਰ ਹਾਂਜੀ ਸਰ ਪੁੱਛੋ ਹਾਂਜੀ ਸਰ ਹਾਂਜੀ ਸਰ ਜਾਂ ਅਸੀਂ ਤੁਹਾਨੂੰ ਦੱਸ ਸਕਦੇ ਆ ਸੱਭਿਆਚਾਰ ਬਾਰੇ ਪੰਜਾਬ ਦੇ ਜਿਵੇਂ ਕਿ ਇਥੇ ਬਹੁਤ ਹੀ ਮਤਲਬ ਇਤਹਾਸਿਕ ਗੁਰਦੁਆਰੇ ਸਾਹਿਬ ਹਨ ਅਤੇ ਇੱਥੇ ਹਨਾ ਦੁਸਹਿਰਾ ਤੀਆਂ ਹੋਰ ਸੱਭਿਆਚਾਰ ਆਦਿ ਤਿਉਹਾਰ ਮਨਾਏ ਜਾਂਦੇ ਹਨ ਜੋ ਕਿ ਪਿੰਡਾ ਵਿੱਚ ਬਹੁਤ ਮਸ਼ਹੂਰ ਹਨ ਹਾਂਜੀ ਸਰ ਤੁਸੀਂ ਕਿਹੜੇ ਤਿਉਹਾਰ ਬਾਰੇ ਪੁੱਛਣਾ ਜਾਂ ਕੋਈ ਮੇਲੇ ਬਾਰੇ ਮਤਲਬ ਇਥੇ ਜਿਵੇਂ ਕੀ ਬਹੁਤ ਹੀ ਮੰਨਤਾਂ ਪੂਰੀਆਂ ਹੁੰਦੀਆਂ ਹਨ ਜੋ ਕਿ ਲੋਕ ਬੜੀ ਦੂਰੋ ਦੂਰ ਤਾਂ ਆਪਾਂ ਆਉਂਦੇ ਹਨ ਪੂਰੀ ਸ਼ਰਧਾ ਨਾਲ ਉਥੇ ਖੇਡਾਂ ਸਮਾਨ ਆਦਿ ਦੀਆਂ ਦੁਕਾਨਾਂ ਲੱਗਦੀਆਂ ਹਨ ਹਾਂਜੀ ਸਰ ਹਾਂਜੀ ਸਰ ਉਹ ਮੈਂ ਤੁਹਾਨੂੰ ਈਮੇਲ ਕਰ ਦਵਾਂਗੀ ਹਾਂਜੀ ਸਰ ਉਹ ਸਾਰਾ ਪ੍ਰਾਈਜ਼ ਆ ਮਤਲਬ ਕਿ ਈਮੇਲ ਕੀਤੀ ਜਾਵੇਗੀ ਤੁਹਾਨੂੰ ਹਾਂਜੀ ਸਰ ਹੋਰ ਜਿਵੇਂ ਕਿ ਦੁਸ਼ਹਿਰਾ ਆਦਿ ਇਥੇ ਬਹੁਤ ਹੀ ਜਿਆਦਾ ਤਿਉਹਾਰ ਮਨਾਏ ਜਾਂਦੇ ਹਨ ਪੰਜਾਬ ਵਿੱਚ ਜੋ ਕਿ ਬਹੁਤ ਮਸ਼ਹੂਰ ਸਨ ਹਾਂਜੀ ਸਰ ਹੋਰ ਕਈ ਸੱਭਿਆਚਾਰ ਬਾਰੇ ਪੁਛਣਾ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ ਓਕੇ ਸਰ ਜਿਵੇਂ ਕਿ ਹਨਾ ਇਥੇ ਹੋਰ ਵੀ ਦਿਵਾਲੀ ਆਦਿ ਤਿਉਹਾਰ ਮਨਾਏ ਜਾਂਦੇ ਨੇ ਜੋ ਕਿ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਹਨ ਪੰਜਾਬ ਵਿੱਚ ਹਰੇਕ ਦੁਕਾਨ ਦੀ ਉਸ ਦਿਨ ਸਜਾਵਟ ਕੀਤੀਆਂ ਹਨ ਦਿਵਾਲੀ ਦੇ ਤਿਉਹਾਰ ਲਈ ਹਾਂਜੀ ਸਰ ਤੁਸੀਂ ਇਸ ਕਰਕੇ ਤੁਸੀਂ ਪੰਜਾਬ ਦੇ ਕਿਸੇ ਵੀ ਹਿੱਸੇ ਵਿੱਚ ਘੁੰਮ ਸਕਦੇ ਹਨ ਜੋ ਕਿ ਬਹੁਤ ਹੀ ਸੱਭਿਆਚਾਰ ਨਾਲ ਭਰਪੂਰ ਹੈ ਹਾਂਜੀ ਸਰ ਮੈਂ ਤੁਹਾਨੂੰ ਆਪਣਾ ਐਡਰੈੱਸ ਈਮੇਲ ਕਰ ਦਵਾਂਗੀ ਠੀਕ ਸਰ